ਪੰਜਾਬ ਦੇ ਵਿੱਚ ਸੱਭਿਆਚਾਰਕ ਸਮਾਗਮ ਜਾਂ ਤਿਉਹਾਰ ਬਹੁਤ ਹੀ ਵੱਧ ਚੜ੍ਹ ਕੇ ਮਨਾਏ ਜਾਂਦੇ ਹਨ ਜਿਸ ਤਰ੍ਹਾਂ ਕਿ ਦੀਵਾਲੀ ਦਾ ਤਿਉਹਾਰ ਦੀਵਾਲੀ ਵਾਲੇ ਦਿਨ ਲੋਕ ਸ਼ੋਪਿੰਗ ਕਰਨਾ ਗਿਫਟ ਦੇਣਾ ਮਿਠਾਈਆਂ ਵੰਡਣਾ ਆਦਿ ਤਰੀਕਿਆਂ ਦੇ ਨਾਲ ਆਪਣਾ ਤਿਉਹਾਰ ਮਨਾਉਂਦੇ ਹਨ ਦੀਵਾਲੀ ਦੀ ਰਾਤ ਨੂੰ ਨਜ਼ਾਰਾ ਵੇਖਣਾ ਬਣਦਾ ਹੈ ਦੀਵਾਲੀ ਵਾਲੀ ਰਾਤ ਲੋਕ ਆਤਿਸ਼ਬਾਜ਼ੀ ਚਲਾਉਂਦੇ ਹਨ ਦੀਪਮਾਲਾ ਕਰਦੇ ਹਨ ਇਸ ਤੋਂ ਬਾਅਦ ਸਰਦ ਰੁੱਤ ਸ਼ੁਰੂ ਹੁੰਦਿਆਂ ਹੀ ਲੋਹੜੀ ਦਾ ਤਿਉਹਾਰ ਹੁੰਦਾ ਹੈ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਕੀਤੀ ਜਾਂਦੀ ਹੈ ਮੂੰਗਫਲੀਆਂ ਰਿਉੜੀਆਂ ਵੰਡੀਆਂ ਜਾਂਦੀਆਂ ਹਨ ਨਵੇਂ ਵਿਆਹੇ ਜੋੜੇ ਜਾਂ ਜਿਨ੍ਹਾਂ ਦੇ ਘਰ ਬੱਚਾ ਹੋਇਆ ਹੁੰਦਾ ਹੈ ਉਹ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਇਸ ਤੋਂ ਬਾਅਦ ਇੱਕ ਦੋ ਮਹੀਨੇ ਬਾਅਦ ਹੀ ਹੋਲੀ ਦਾ ਤਿਉਹਾਰ ਆ ਜਾਂਦਾ ਹੈ ਹੋਲੀ ਇੱਕ ਰੰਗਾਂ ਦਾ ਤਿਉਹਾਰ ਹੈ ਹੋਲੀ ਵਾਲੇ ਦਿਨ ਲੋਕ ਇੱਕ ਦੂਜੇ 'ਤੇ ਰੰਗ ਸੁੱਟਦੇ ਹਨ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ ਸੱਭਿਆਚਾਰਕ ਸਮਾਗਮਾਂ ਦਾ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਰੋਲ ਹੈ ਪੰਜਾਬੀ ਗਾਣੇ ਸੁਣਨੇ ਧਾਰਮਿਕ ਗਾਣੇ ਸੁਣਨੇ ਭੰਗੜਾ ਪਾਉਣਾ ਪੰਜਾਬੀਆਂ ਦੇ ਖੂਨ ਦੇ ਵਿੱਚ ਹੈ ਗਾਣੇ ਗਾ ਕੇ ਭੰਗੜਾ ਪਾ ਕੇ ਲੋਕ ਆਪਣੇ ਆਪ ਨੂੰ ਆਨੰਦਿਤ ਮਹਿਸੂਸ ਕਰਦੇ ਹਨ ਪੰਜਾਬ ਦੇ ਗਾਣੇ ਪੰਜਾਬ ਦਾ ਭੰਗੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ